ਸਤਿ ਸ਼੍ਰੀ ਅਕਾਲ ਜੀ ਖਾਣ ਬਾਰੇ ਖਾਣਾ ਦੇ ਪਕਵਾਨ ਦਾ ਸਵਾਦ ਉਸ ਸਮੇਂ ਆਉਂਦਾ ਹੈ ਜਦੋਂ ਖਾਣ ਵਾਲੇ ਪਕਵਾਨਾਂ ਵਿੱਚ ਮਸਾਲਾ ਅਤੇ ਘਰ ਦਾ ਬਣਿਆ ਪਿਆ ਹੋਵੇ ਅਤੇ ਜਿਹੜਾ ਵੀ ਅਸੀਂ ਪਕਵਾਨ ਖਾਂਦੇ ਹੈ ਉਹਦੇ ਵਿੱਚ ਜਿਵੇਂ ਕਿ ਲਗਾ ਲਓ ਤੁਸੀਂ ਮੈਂ ਕੇਕ ਬਣਾਇਆ ਏ ਕੇਕ ਵਿੱਚ ਜਿਹੜਾ ਵੀ ਸਮਾਨ ਪੈਣਾ ਏ ਉਹ ਸਾਫ ਸੁਥਰਾ ਹੋਣਾ ਚਾਹੀਦਾ ਏ ਅਤੇ ਸਾਨੂੰ ਇਸ ਚੀਜ਼ ਦਾ ਵੀ ਖਾਣ ਵਾਲੇ ਚੀਜ਼ਾਂ ਇਸ ਦਾ ਧਿਆਨ ਰੱਖਣਾ ਚਾਹੀਦਾ ਬਣਾਉਣ ਵੇਲੇ ਕਿ ਉਹਦੇ ਵਿੱਚ ਮੋਟਾਪਾ ਨਾ ਹੋਵੇ ਜਾਂ ਕੋਈ ਬਿਮਾਰੀ ਦਾ ਘਰ ਨਾ ਹੋਵੇ ਕੋਈ ਵੀ ਖਾਣ ਦਾ ਸਾਨੂੰ ਐਵੇਂ ਦਾ ਰੱਖਣਾ ਚਾਹੀਦਾ ਏ ਆਪਣਾ ਅਤੇ ਅਹ ਜਿਵੇਂ ਕਿ ਲਗਾ ਲਉ ਆਪਾਂ ਕੋਈ ਸਬਜ਼ੀ ਬਣਾਉਂਦੇ ਹੈ ਸਬਜ਼ੀ 'ਚ ਮਸਾਲੇ ਜ਼ਿਆਦਾ ਨਹੀਂ ਹੋਣੇ ਚਾਹੀਦੇ ਅਤੇ ਉਹਦਾ ਖਾਣ ਦਾ ਸਵਾਦ ਵੀ ਬਹੁਤ ਵਧੀਆ ਆਉਂਦਾ ਏ ਅਤੇ ਖਾਣਾ ਪੀਣਾ ਐਵੇਂ ਦਾ ਹੋਣਾ ਚਾਹੀਦਾ ਕਿ ਸਾਰਾ ਪਰਿਵਾਰ ਮਿਲ ਕੇ ਖਾਵੇ ਅਤੇ ਉਹਦਾ ਸਵਾਦ ਵੀ ਆਵੇ ਅਤੇ ਖਾਣ ਦਾ ਆਨੰਦ ਅਸੀਂ ਉਦੋਂ ਹੀ ਲੈ ਸਕਦੇ ਹੈ ਜਿਵੇਂ ਕਿ ਅਸੀਂ ਮਟਰ ਪਨੀਰ ਦੀ ਸਬਜ਼ੀ ਬਣਾਉਣੀ ਹੈ ਉਹਦੇ ਨਾਲ ਪੂਰੀਆਂ ਬਣਾ ਲਓ ਜਾਂ ਸਿੰਪਲ ਰੋਟੀ ਅਤੇ ਮਿੱਸੀ ਰੋਟੀ ਜਾਂ ਜਿਵੇਂ ਵੀ ਹੈ ਜਿਹੜਾ ਖਾਣਾ ਪੀਣਾ ਹੁੰਦਾ ਏ ਉਹ ਵਧੀਆ ਹੋਣਾ ਚਾਹੀਦਾ ਏ ਖਾਣ ਲਈ ਸਾਨੂੰ ਸਬਜ਼ੀ ਬਣਾਉਣ ਲਈ ਟਮਾਟਰ ਪਿਆਜ਼ ਮਿਰਚਾਂ ਅਦਰਕ ਮਸਾਲਾ ਗਰਮ ਮਸਾਲਾ ਕਾਲੀ ਮਿਰਚ ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਬਹੁਤ ਵਧੀਆ ਪਕਵਾਨ ਪੱਕਦੇ ਨੇ ਅਤੇ ਗੁਲਾਬ ਜਾਮਣਾ ਵੀ ਬਣਦੀਆਂ ਏ ਜਿਹੜਾ ਗੁਲਾਬ ਜਾਮਣਾ ਬਣਦੀਆਂ ਏ ਉਹ ਵੀ ਬਹੁਤ ਵਧੀਆ ਹੁੰਦੀਆਂ ਏ ਅਤੇ ਉਹਦਾ ਜਿਹੜਾ ਘਰ ਆਪਾਂ ਰਸ ਬਣਾਉਂਦੇ ਨੇ ਉਹ ਵੀ ਬਹੁਤ ਵਧੀਆ ਹੁੰਦੇ ਨੇ ਅਤੇ ਜਿਹੜੀਆਂ ਵੀ ਚੀਜ਼ਾਂ ਖਾਣ ਪੀਣ ਵਾਲੀਆਂ ਹੁੰਦੀਆਂ ਉਹਦੇ ਵਿੱਚ ਅਸੀਂ ਆਪਣੇ ਘਰ ਬਣਾਉਂਦੇ ਹਾਂ ਜਿਹੜਾ ਉਹ ਬਹੁਤ ਵਧੀਆ ਸਾਫ ਸੁਥਰਾ ਹੁੰਦਾ ਏ ਅਤੇ ਅਸੀਂ ਉਹਨੂੰ ਜਿੰਨੀ ਵਾਰ ਵੀ ਬਣਾਈਏ ਉਨਾਂ ਸਵਾਦ ਆਉਂਦਾ ਏ ਅਤੇ